ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ ਅੱਛਾ ਅੱਛਾ ਸਰ ਕੋਈ ਨਾ ਸਰ ਤੁਸੀਂ ਮਤਲਬ ਕੋਲ ਕੀਤੀ ਹੈ ਤਾਂ ਵਧੀਆ ਬ੍ਰੈਂਡ ਦੱਸਾਂਗੇ ਨਾਇਕੀ ਪਿਆ ਸਰ ਨਾਇਕੀ ਆ ਬਾਟਾ ਗੁਚੀ ਫਿਰ ਉਹ ਵੀ ਪਿਆ ਆਪਣੇ ਤੋਂ ਜੋਡਨ ਵੀ ਪਏ ਆ ਤੁਸੀਂ ਦੱਸੋ ਤੁਹਾਨੂੰ ਕਿਹੜਾ ਬ੍ਰੈਂਡ ਚਾਹੀਦਾ ਸਰ ਬਜਟ ਤਾਂ ਮਤਲਬ ਨੌ ਹਜ਼ਾਰ ਤੋਂ ਸ਼ੁਰੂ ਹੈ ਅਤੇ ਅੱਗੇ ਤੱਕ ਔਫਰ ਮਤਲਬ ਹੋਣਗੇ ਪੰਦਰਾਂ ਸੋਲਾਂ ਹਜ਼ਾਰ ਤੱਕ ਚੱਲ ਜਾਂਦਾ ਔਫਰ ਨਾਇਕੀ ਦੇ ਤਾਂ ਸ਼ੂਜ ਦਾ ਮਤਲਬ ਵਰਾਇਟੀ ਤਾਂ ਕਾਫ਼ੀ ਹੈ ਜੇ ਤੁਹਾਨੂੰ ਨਾਈਕੀ ਦੇ ਚਾਹੀਦੇ ਹੈ ਤਾਂ ਤੁਹਾਨੂੰ ਉਹ ਮਤਲਬ ਨੌ ਹਜ਼ਾਰ ਤੋਂ ਸ਼ੁਰੂ ਹੋ ਜਾਣੇ ਪ੍ਰਾਈਜ ਉਹਦਾ ਅਤੇ ਅੱਗੇ ਫਿਰ ਵੱਧਦਾ ਜਾਣਾ ਹਾਂਜੀ ਹਾਂਜੀ ਸਰ ਡਿਸਕਾਊਟ ਵੀ ਚਲਦੇ ਪਏ ਆ ਹੋਲੀ ਦਾ ਮਤਲਬ ਹੋਲੀ ਆਈ ਹੈ ਤਾਂ ਡਿਸਕਾਊਟ ਤਾਂ ਜ਼ਰੂਰ ਮਿਲਣਗੇ ਤੁਹਾਨੂੰ ਅਤੇ ਜਿਹੜਾ ਨੌ ਹਜ਼ਾਰ ਦਾ ਸ਼ੂਜ਼ ਆ ਤੁਹਾਨੂੰ ਪੈ ਜਾਊਗਾ ਪੰਜ ਹਜ਼ਾਰ ਤੱਕ ਪੈ ਜਾਊਗਾ ਉਹ ਡਿਸਕਾਊਟ ਦੇ ਬਾਅਦ ਡਿਲੀਵਰੀ ਵਗੈਰਾ ਸਰ ਤੁਸੀਂ ਔਨਲਾਈਨ ਵੀ ਕਰਵਾ ਸਕਦੇ ਜੇ ਤੁਸੀਂ ਚਾਹੋ ਤਾਂ ਵੈੱਬਸਾਈਟ ਤੋਂ ਮਤਲਬ ਔਰਡਰ ਹੋ ਜਾਵੇਗਾ ਅਤੇ ਉਹ ਹੋਮ ਡਿਲੀਵਰੀ ਹੋ ਜਾ ਜਾਵੇਗੀ ਅਤੇ ਚਾਰਜਿਸ ਉਹਦੇ ਮਤਲਬ ਐਕਸਟਰਾ ਪੈਣਗੇ ਥੋੜ੍ਹੇ ਜਿਹੇ ਅਤੇ ਜਾਂ ਤੁਸੀਂ ਸਟੋਰ 'ਤੇ ਵਿਜਿਟ ਕਰਕੇ ਵੀ ਮਤਲਬ ਆਪਣਾ ਜਿਹੜਾ ਤੁਹਾਡਾ ਮਨ ਪਸੰਦ ਤੁਹਾਡਾ ਸ਼ੂਜ਼ ਹੋਵੇਗਾ ਬ੍ਰੈਂਡ ਹੋਵੇਗਾ ਉੱਥੋਂ ਤੁਸੀਂ ਲੈ ਸਕਦੇ ਹੋ ਸ਼ੂਜ਼ ਹਾਂਜੀ ਹਾਂਜੀ ਥੈਂਕ ਯੂ ਸਰ ਓਕੇ ਥੈਂਕ ਯੂ ਸਰ